ਹਾਂਜੀ ਬਿਲਕੁਲ ਸਾਡੇ ਖੇਤਰ ਦੇ ਵਿਦਿਆਰਥੀ ਸਕੂਲਾਂ 'ਚ ਬਹੁਤ ਦੌੜਨਾ ਪਸੰਦ ਕਰਦੇ ਹਨ ਅਤੇ ਉਹ ਦੌੜਾਂ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ ਅਤੇ ਇਹ ਬਹੁਤ ਚੰਗੀ ਗੱਲ ਹੈ ਬੱਚਿਆਂ ਨੂੰ ਦੌੜਨਾ ਚਾਹੀਦਾ ਹੈ ਕਿਉਂਕਿ ਦੌੜਨ ਦੇ ਨਾਲ ਉਹਨਾਂ ਦੀ ਪੂਰੀ ਸਰੀਰਕ ਕਸਰਤ ਹੋ ਜਾਂਦੀ ਹੈ ਅਤੇ ਬੱਚੇ ਸਿਹਤਮੰਦ ਰਹਿੰਦੇ ਹੈ ਬਿਮਾਰੀਆਂ ਤੋਂ ਦੂਰ ਰਹਿੰਦੇ ਹੈ ਇਸ ਤੋਂ ਬਿਨਾਂ ਅੱਜ ਦੀ ਸਭ ਤੋਂ ਵੱਡੀ ਬਿਮਾਰੀ ਜੋ ਹੈ ਮੋਬਾਈਲ ਵਗੈਰਾ ਜਾਂ ਇਨਡੋਰ ਖੇਡਾਂ ਉਹਨਾਂ ਦੀ ਬਜਾਏ ਜਦੋਂ ਬੱਚੇ ਦੌੜਦੇ ਹੈ ਤਾਂ ਉਹਨਾਂ ਦੀ ਪੂਰੀ ਸਰੀਰਕ ਕਸਰਤ ਹੁੰਦੀ ਹੈ ਅਤੇ ਉਹ ਐਕਟਿਵ ਰਹਿੰਦੇ ਹੈ ਅਤੇ ਉਹਨਾਂ ਦੇ ਵਿੱਚ ਚੁਸਤੀ ਫੁਰਤੀ ਵਰਗੇ ਗੁਣ ਜਿਹੜੇ ਹੈ ਪੈਦਾ ਹੁੰਦੇ ਹੈ ਇਸ ਲਈ ਖੇਡਣਾ ਦੌੜਨਾ ਬੱਚਿਆਂ ਲਈ ਬਹੁਤ ਜ਼ਰੂਰੀ ਹੈ ਅਤੇ ਬੱਚੇ ਦੀ ਸਿਹਤ ਵਾਸਤੇ ਬਹੁਤ ਹੀ ਚੰਗਾ ਹੈ ਅਤੇ ਸਾਡੇ ਰੋਪੜ ਦੇ ਖੇਤਰ ਦੇ ਖਾਸ ਕਰਕੇ ਵਿਦਿਆਰਥੀ ਜਿਹੜੇ ਹੈ ਦੌੜਾਂ ਦੋੜ ਮੁਕਾਬਲਿਆਂ ਵਿੱਚ ਪੂਰੀ ਤਰ੍ਹਾਂ ਨਾਲ ਐਕਟਿਵ ਹੋ ਕੇ ਹਿੱਸਾ ਲੈਂਦੇ ਹੈ